ਘੋਲ ਕਬੱਡੀ ਹਾਕੀ ਜਿਹਨੂੰ ਖਿੱਦੋ ਖੁੰਡੀ ਕਹਿੰਦੇ ਸੀ ਪਹਿਲਾਂ ਤਾਂ ਕਾਫ਼ੀ ਆਪਣੀਆਂ ਜਿਹੜੀਆਂ ਮਤਲਬ ਫੁੱਟਬਾਲ ਅਤੇ ਇੱਕ ਆਪਣੀ ਜਿਹੜੀਆਂ ਰਿਵਾਇਤੀ ਖੇਡਾਂ ਆ ਅਤੇ ਇਹਦੇ ਨਾਲ ਆਪਣੀ ਜਿਹੜੀਆਂ ਆਪਣੀਆਂ ਖੇਡਾਂ ਆ ਇਹਨੂੰ ਜਦੋਂ ਆਪਾਂ ਆਪਾਂ ਨੂੰ ਉਤਲੇ ਲੈਵਲ ਤੱਕ ਖੜਦੇ ਹਾਂ ਤਾਂ ਪਤਾ ਲੱਗਦਾ ਕਿ ਸਾਡੀ ਇਹ ਇਹ ਜੀ ਸਾਡੀਆਂ ਪੇਂਡੂ ਖੇਡਾਂ ਵਾ ਅਤੇ ਇਹਨਾਂ ਨੂੰ ਆਪਾਂ ਹਾਈਜ ਲੈਵਲ ਤੱਕ ਲੈ ਕੇ ਵੀ ਜਾਂਦੇ ਹਾਂ ਇਹਦੇ ਨਾਲ ਸਾਨੂੰ ਕਾਫ਼ੀ ਚਲੋ ਵਧੀਆ ਰਹਿੰਦਾ ਅਤੇ ਜਦੋਂ ਆਪਾਂ ਖੇਡਦੇ ਹਾਂ ਪਿੰਡਾਂ ਦੇ ਵਿੱਚ ਦੂਜੇ ਇੱਕ ਪਿੰਡ ਤੋਂ ਦੂਜੇ ਪਿੰਡ ਖੇਡਣ ਜਾਂਦੇ ਹਾਂ ਅਤੇ ਉੱਥੇ ਜੇ ਭਾਈ ਜਦੋਂ ਜਾ ਕੇ ਅਤੇ ਨਵੀਂ ਥਾਂ 'ਤੇ ਜਾਈ ਦਾ ਖੇਡਣ ਭਾਈਚਾਰਕ ਸਾਂਝ ਪਿੰਡ ਦੀ ਦੂਜੇ ਪਿੰਡ ਤੋਂ ਦੂਜੀ ਥਾਂ ਤੱਕ ਵੱਧਦੀ ਆ ਅਤੇ ਨੌਜਵਾਨ ਜਿਹੜੇ ਜਦੋਂ ਖੇ ਖੇਡਾਂ ਵੱਲ ਧਿਆਨ ਹੋਵੇ ਤਾਂ ਇੱਕ ਨਸ਼ਿਆਂ ਤੋਂ ਮੁਕਤ ਰਹਿੰਦੇ ਆ ਅਤੇ ਇਹ ਉਤਲੇ ਲੈਵਲ ਤੱਕ ਸਾਨੂੰ ਖੇਡਾਂ ਲੈ ਕੇ ਜਾਂਦੀਆਂ ਸਰੀਰਕ ਤੰਦਰੁਸਤੀ ਰਹਿੰਦੀ ਹੈ ਜਦੋਂ ਬਹਿ ਕੇ ਆਪਸ ਵਿੱਚ ਸਮਾਂ ਨਿਕਲ ਜਾਂਦਾ ਹਰ ਇੱਕ ਦਾ ਜਾਣੀ ਕਿ ਇਹ ਬਹੁਤ ਹੀ ਵਧੀਆ ਹਰ ਇੱਕ ਜਾਣੀ ਕਿ ਟਾਈਮ ਪਾਸ ਵੀ ਇਹਦੇ ਨਾਲ ਵਧੀਆ ਹੁੰਦਾ ਅਤੇ ਵਧੀਆ ਰਹਿੰਦੀਆਂ ਗੇਮਾਂ ਹਾਂਜੀ